ਸਤਿ ਸ਼੍ਰੀ ਅਕਾਲ ਮੇਰਾ ਨਾਮ ਜਸ਼ਨਪ੍ਰੀਤ ਕੌਰ ਹੈ ਮੈਂ ਅ ਮੈਂ ਪ੍ਰਭਦੀਪ ਟਰੈਵਲ ਤੋਂ ਆਪਣੀ ਕੈਬ ਬੁੱਕ ਕੀਤੀ ਸੀ ਜਿਸ ਵਿੱਚ ਮੈਨੇ ਪਟਿਆਲੇ ਤੋਂ ਚੰਡੀਗੜ੍ਹ ਜਾਣਾ ਸੀ ਇਸ ਵਿੱਚ ਮੈਨੇ ਦੇਖਿਆ ਕਿ ਜਿਹੜਾ ਇਸ ਦਾ ਡਰਾਈਵਰ ਸੀ ਉਸਨੇ ਕੋਵਿਡ ਦੇ ਚੱਲਦੇ ਮਾਸਕ ਦੀ ਵਰਤੋਂ ਨਹੀਂ ਕੀਤੀ ਸੀ ਉਹ ਬਿਨਾਂ ਮਾਸਕ ਹੀ ਗੱਡੀ ਚਲਾ ਰਿਹਾ ਸੀ ਅਤੇ ਇਸ ਵਿੱਚ ਗੱਡੀ ਦੀਆਂ ਸੀਟਾਂ ਵੀ ਬਹੁਤ ਜ਼ਿਆਦਾ ਗੰਦੀਆਂ ਸਨ ਜਦੋਂ ਉਹ ਕੈਬ ਵਿੱਚ ਗੱਡੀ ਚੈੱਕ ਕਰਨ ਲਈ ਇੱਕ ਦੋ ਵਾਰ ਬਾਹਰ ਨਿਕਲਿਆ ਤਾਂ ਉਸਨੇ ਆਪਣੇ ਹੱਥਾਂ ਨੂੰ ਵੀ ਸੈਨੀਟਾਈਜ਼ ਨਹੀਂ ਕੀਤਾ ਸੀ ਇਸ ਤਰ੍ਹਾਂ ਦੀ ਅਣਗਹਿਲੀ ਦੇਖ ਕੇ ਮੈਂ ਬਹੁਤ ਹੀ ਜ਼ਿਆਦਾ ਨਿਰਾਸ਼ ਹੋਈ ਮੈਂ ਪਹਿਲਾਂ ਤੁਹਾਡੇ ਤੋਂ ਹੀ ਹਮੇਸ਼ਾ ਕੈਬ ਬੁੱਕ ਕਰਦੀ ਸੀ ਕਦੇ ਵੀ ਇਹੋ ਜਿਹਾ ਮੈਨੂੰ ਦੇਖਣ ਲਈ ਨਹੀਂ ਮਿਲਿਆ ਪਰ ਇਸ ਚੀਜ਼ ਨੂੰ ਲੈ ਕੇ ਮੈਂ ਬਹੁਤ ਹੀ ਜ਼ਿਆਦਾ ਨਿਰਾਸ਼ ਹੋਈ ਅੱਗੇ ਤੋਂ ਮੈਂ ਉਮੀਦ ਕਰਾਂਗੀ ਜਾਂ ਤਾਂ ਤੁਸੀਂ ਆਪਣੇ ਡਰਾਈਵਰਸ ਨੂੰ ਕਹੋ ਕਿ ਉਹ ਵਧੀਆ ਤਰੀਕੇ ਨਾਲ਼ ਸੈਨੀਟਾਈਜ਼ ਕਰਨ ਆਪਣੇ ਹੱਥ ਅਤੇ ਮਾਸਕ ਪਾਉਣ ਲਈ ਵੀ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਧੰਨਵਾਦ